ਹਾਂਜੀ ਕੌਣ ਬੋਲ ਰਹੇ ਜੀ ਬੇਟਾ ਮੈਂ ਤੁਹਾਡੇ ਸਕੂਲ ਐਡ ਐਡਮੀਸਟੇਸ਼ਨ ਦਾ ਮੈਂਬਰ ਸੰਦੀਪ ਸਿੰਘ ਬੋਲ ਰਿਹਾ ਹਾਂ ਬੇਟਾ ਤੁਸੀਂ ਰੈਗੂਲਰ ਰੋਜ਼ ਸਕੂਲ ਆ ਰਹੇ ਜੇ ਬੇਟਾ ਕੋਈ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਸਕੂਲ ਦੇ ਵਿੱਚ ਹਾਂਜੀ ਬੇਟਾ ਦੱਸੋ ਓਕੇ ਬੇਟਾ ਬੇਟਾ ਇਹ ਬੇਸਿਕ ਨੀਡਸ ਨੇ ਅਸੀਂ ਇੱਕ ਦੋ ਦਿਨ ਦੇ ਅੰਦਰ ਹੀ ਕਲੀਅਰ ਕਰਵਾ ਦੇਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਪੜ੍ਹਾਈ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਚਾਹੀਦਾ ਜਿਸ ਦੇ ਨਾਲ ਤੁਹਾਡੀ ਜਿਹੜੀ ਹੈ ਮੈਂਟਲਟੀ ਜਿਹੜੀ ਹੋਰ ਗਰੋਅ ਕਰ ਸਕੇ ਕੋਈ ਚੇਂਜਿਜ ਚਾਹੁੰਦੇ ਹੋ ਓਕੇ ਓਕੇ ਬੇਟੇ ਓਕੇ ਬੇਟਾ ਬੇਟਾ ਥੈਂਕਸ ਤੁਹਾਡਾ ਇਹ ਗੱਲ ਮੇਰੇ ਮਾਈਂਡ 'ਚ ਲਿਆਉਣ ਲਈ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਬਾਕੀ ਸਬਜੈਕਟ ਦੇ ਟੀਚਰ ਨੇ ਉਹ ਸਭ ਵਧੀਆ ਰਿਸਪੋਂਸ ਦੇ ਰਹੇ ਨੇ ਓਕੇ ਬੇਟਾ ਥੈਂਕਸ ਤੁਹਾਡਾ ਰਿਸਪੋਂਸ ਬਹੁਤ ਵਧੀਆ ਰਿਹਾ ਥੈਂਕਸ ਸੋ ਮਚ